ਸਮੁੱਚੀ ਸਿਹਤ ਅਤੇ ਤੰਦਰੁਸਤੀ ਲਈ ਤੈਰਾਕੀ ਦੇ ਬਹੁਤ ਹੀ ਫਾਇਦੇ ਹਨ ਕੋਈ ਵੀ ਸਪੋਟਸ ਜਾਂ ਐਕਸਸਾਈਜ ਹੋਵੇ ਉਹਦੇ ਆਪਣੀ ਸਿਹਤ ਦੇ ਲਈ ਫ ਫਾਇਦੇ ਫਾਇਦੇਮੰਦ ਹੁੰਦੀ ਹੀ ਹੈ ਜੇਕਰ ਤੈਰਾਕੀ ਦੀ ਗੱਲ ਕਰੀਏ ਤਾਂ ਤੈਰਾਕੀ ਦਾ ਸਾਹ ਦੇ ਨਿਰੰਤਰਣ ਬਣਾਉਣ ਵਿੱਚ ਬਹੁਤ ਹੀ ਵੱਡਾ ਹੱਥ ਹੈ ਸ ਮਤਲਬ ਸਾਹ ਦਾ ਨਿਰੰਤਰਣ ਬਣਾਉਣ ਲਈ ਸਭ ਤੋਂ ਬੇਸਟ ਸਪੋਟਸ ਤੈਰਾਕੀ ਹੀ ਹੈ ਇਸ ਤੋਂ ਇਲਾਵਾ ਤੈਰਾਕੀ ਦੇ ਅਸਥਮਾ ਦੀਆਂ ਪ੍ਰੋਬਲਮ ਜਿਹ 'ਚ ਸਾਹ ਦੀ ਪ੍ਰੋਬਲਮ ਕਹਿੰਦੇ ਹਾਂ ਆਪਾਂ ਪੰਜਾਬੀ ਵਿੱਚ ਉਹਦੇ ਲਈ ਵੀ ਬਹੁਤ ਫਾਇਦੇਮੰਦ ਹੈ ਏ ਅਤੇ ਤੈਰਾਕੀ ਦੇ ਲੰਗਜ਼ ਜਿਹੜੇ ਆਪਣੇ ਫੇਫੜੇ ਹੁੰਦੇ ਹੈ ਉਹਨਾਂ ਨੂੰ ਏਰਵੇਜ਼ ਜਿਹੜੇ ਹੁੰਦੇ ਹੈ ਉਹਨਾਂ ਨੂੰ ਕਲੀਅਰ ਕਰਨ 'ਚ ਬਹੁਤ ਹੀ ਬੈਨੀਫੀਸ਼ਲ ਹੈ ਜਿਸ ਨਾਲ਼ ਕਿਆ ਹੈ ਅਗਰ ਪ੍ਰੋਪਰ ਬਰੀਦਿੰਗ ਹੋਵੇਗੀ ਤਾਂ ਏਅਰਵੇਜ਼ ਹੈ ਜਿਹੜੇ ਪ੍ਰੋਪਰ ਓਪਨ ਹੋ ਜਾਂਦੇ ਹਨ ਜਿਸ ਕਾਰਨ ਕੋਈ ਵੀ ਮੈਟਰ ਆਪਾਂ ਇੰਨਹੇਲ ਕਰਦੇ ਹਾਂ ਬਾਹਰ ਤੋਂ ਉਹ ਉਸਦਾ ਜੋ ਖ਼ਤਰਾ ਹੈ ਉਹ ਬਿਮਾਰੀਆਂ ਵਧਾਉਂਦਾ ਹੈ ਉਸ ਤੋਂ ਚਾਨਸਿੰਜ਼ ਬਹੁਤ ਹੀ ਘੱਟ ਜਾਂਦੇ ਹਨ ਇਸ ਕਰਕੇ ਜੇ ਓਵਰਔਲ ਦੇਖਿਆ ਜਾਵੇ ਤਾਂ ਤੈਰਾਕੀ ਦੇ ਸਾਹ ਸਾਹ ਦੇ ਨਿਰੰਤਰਣ ਬਣਾਉਣ 'ਚ ਬਹੁਤ ਹੀ ਮੱਦਦਗਾਰ ਹੈ